ਪੰਜਾਬ ਵਿੱਚ ਬਹੁਤ ਤਰ੍ਹਾਂ ਦੇ ਸਰਕਾਰੀ ਅਤੇ ਪ੍ਰਾਈਵੇਟ ਉਦਯੋਗ ਹਨ ਜਿਹਨਾਂ ਵਿੱਚ ਛੋਟੇ ਵੀ ਹਨ ਅਤੇ ਵੱਡੇ ਵੀ ਹਨ ਇਹ ਸਰਕਾਰੀ ਵੀ ਹਨ ਅਤੇ ਪ੍ਰਾਈਵੇਟ ਵੀ ਹਨ ਇਹਨਾਂ ਸਭ ਨੇ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਹਿੱਸਾ ਪਾਇਆ ਹੈ ਅਤੇ ਪੰਜਾਬ ਨੂੰ ਇੱਕ ਮਜ਼ਬੂਤ ਪ੍ਰਦੇਸ਼ ਬਣਾਇਆ ਹੈ ਇਸ ਵਿੱਚ ਖੇਤੀ ਤੋਂ ਲੈ ਕੇ ਨਿਰਯਾਤ ਅਤੇ ਆਯਾਤ ਵਾਲੇ ਉਦਯੋਗ ਆਦਿ ਸ਼ਾਮਿਲ ਹਨ